ਮੈਂ ਅਤੇ ਮੇਰੇ ਸਹਿਕਰਮੀਆਂ ਨੇ ਆਪਣਾ ਕੰਮ ਪੂਰਾ ਹੋਣ ਤੋਂ ਬਾਅਦ ਰਾਤ ਅੱਠ ਵਜੇ ਫਿਲਮ ਵੇਖਣ ਦਾ ਪ੍ਰੋਗਰਾਮ ਬਣਾਇਆ ਹੈ ਇਹ ਫਿਲਮ ਟਵੈਲਥ ਫੇਲ ਹੈ ਇਸ ਵਿੱਚ ਇੱਕ ਬਾਰ੍ਹਵੀਂ ਫੇਲ ਵਿਦਿਆਰਥੀ ਜਿਹੜਾ ਆਈਐਸ ਅਫਸਰ ਬੰਦਾ ਹੈ ਦੇ ਜੀਵਨ ਬਾਰੇ ਦੱਸਿਆ ਗਿਆ ਹੈ ਇਹ ਫਿਲਮ ਤੋਂ ਸਾਨੂੰ ਹਾਰ ਨਾ ਮੰਨਣ ਦੀ ਪ੍ਰੇਰਨਾ ਮਿਲਦੀ ਹੈ ਮੇਰੇ ਸਾਰੇ ਸਹਿਕਰਮੀ ਆਫਿਸ ਜਾਂਦੇ ਹਨ ਅਤੇ ਉਨਾਂ ਕੋਲ ਰਾਤ ਦਾ ਸਮਾਂ ਹੀ ਉਪਲਬਧ ਹੈ ਮੈਨੂੰ ਆਸ ਹੈ ਕਿ ਉਹ ਇਹ ਸਮੇਂ 'ਤੇ ਫਿਲਮ ਵੇਖਣ ਲਈ ਜ਼ਰੂਰ ਆਉਣਗੇ